ਇਹ ਕਾਰੋਬਾਰ ਸੇਵਾ ਦੀਆਂ ਮੱਦਾਂ ਫੋਟੋ ਅਤੇ ਇਹਨਾਂ ਕਾਰੋਬਾਰ ਸੇਵਾ ਦੀਆਂ ਫੋਟੋ ਨਾਲ ਮੱਦਾਂ ਨਾਲ ਸਹਿਮਤ ਹੋਣ ਵਾਲੇ ਵਿਅਕਤੀ ਅਤੇ ਕਿਸੇ ਵੀ ਸੰਸਥਾ ਵਿਚਕਾਰ ਕਾਨੂੰਨੀ ਤੌਰ ਤੇ ਵੱਜਵਾਂ ਇਕਰਾਰਨਾਮਾ ਬਣਾਉਦੀਆਂ ਹਨ ਜਿਸ ਦੇ ਵੱਲੋਂ ਉਹ ਵਿਅਕਤੀ ਕੰਮ ਕਰ ਰਿਹਾ ਹੈ ਜਿਸ ਸਨੈਪ ਸੰਸਥਾ ਨਾਲ ਤੁਸੀਂ ਸਮਝੌਤਾ ਕਰ ਰਹੇ ਹੋ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ ਜਾਂ ਤੁਹਾਡੀ ਸੰਸਥਾ ਦੇ ਕਾਰੋਬਾਰ ਦੀ ਪ੍ਰਮੁੱਖ ਜਗ੍ਹਾ ਕਿੱਥੇ ਹੈ ਆਪਣੀ ਜਾ ਆਪਣੀ ਨਿੱਜੀ ਸਮਰੱਥਾ ਵਿੱਚ ਕਾਰੋਬਾਰੀ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਵਿਅਕਤੀ ਲਈ ਜੇਕਰ ਵਿਅਕਤੀ ਸੰਯੁਕਤ ਰਾਜ ਵਿੱਚ ਰਹਿੰਦਾ ਹੈ ਸਨੈਪ ਦਾ ਅਰਥ ਸਨੈਪ ਇੰਕ ਅਤੇ ਸਨੈਪ ਗਰੁੱਪ ਲਿਮਿਟਡ ਹੁੰਦਾ ਹੈ ਉਸ ਵਿਅਕਤੀ ਲਈ ਜੋ ਸੰਯੁਕਤ ਰਾਜ ਤੋਂ ਬਾਹਰ ਰਹਿੰਦਾ ਹੈ ਜੇਕਰ ਵਿਅਕਤੀ ਕਿਸੇ ਇਕਾਈ ਦੀ ਤਰਫੋਂ ਕਾਰੋਬਾਰੀ ਸੇਵਾਵਾਂ ਦੀ ਵਰਤੋਂ ਕਰ ਰਿਹਾ ਹੈ ਅਤੇ ਉਸ ਸੰਸਥਾ ਦੇ ਕਾਰੋਬਾਰ ਦਾ ਪ੍ਰਮੁੱਖ ਸਥਾਨ ਸੰਯੁਕਤ ਰਾਜ ਵਿੱਚ ਹੈ ਇਹਨਾਂ ਦੀਆਂ ਪਾਬੰਦੀਆਂ ਇਹਨਾਂ ਦੀਆਂ ਪਾਬੰਦੀਆਂ ਤੋਂ ਇਲਾਵਾ ਤੁਸੀਂ ਕਿਸੇ ਹੋਰ ਧਿਰ ਨੂੰ ਅਧਿਕਾਰ ਹੌਸਲਾ ਜਾ ਇਜਾਜ਼ਤ ਨਹੀਂ ਦੇਵੋਗੇ ਇਹਨਾਂ ਸੋਫਟ ਨਾਲ ਸੇਵਾਵਾਂ ਦੀ ਵਰਤੋਂ ਕਰਨ ਜਾਂ ਮਿਲ ਕੇ ਇਹਨਾਂ ਕਾਰੋਬਾਰੀ ਸੇਵਾਵਾਂ ਦੀਆਂ ਮੱਦਾਂ ਦੇ ਉਲਟ ਸੇਵਾਵਾਂ ਦੇ ਸਬੰਧ ਵਿੱਚ ਜੁੰਮੇਵਾਰੀਆਂ ਦੀ ਤਿਆਰੀ ਜਾਂ ਕਿਸੇ ਤੀਜੀ ਧਿਰ ਨੂੰ ਕਿਸੇ ਵੀ ਅਧਿਕਾਰ ਜਾਂ ਅਧੀਨ ਛੋਟਾਂ ਦੇਣ ਦਾ ਇਰਾਦਾ ਸਨੈਪ ਦੀ ਬੌਧਿਕ ਜਾਇਦਾਦ ਜਾਂ ਸੇਵਾਵਾਂ ਦੀ ਮਲਕੀਅਤ ਦੇ ਅਧਿਕਾਰ ਵਿੱਚ ਇਹ ਸਨੈਪ ਦੀ ਪੂਰਵ ਲਿਖਤੀ ਸਹਿਮਤੀ ਤੋਂ ਬਿਨਾਂ ਕਿਸੇ ਵੀ ਉਦੇਸ਼ ਲਈ ਸੇਵਾਵਾਂ ਦੇ ਮਾਧਿਅਮ ਰਾਹੀ ਕਿਸੇ ਵੀ ਨਿੱਜੀ ਡਾਟਾ ਨੂੰ ਇਕੱਠਾ ਕਰਨ ਪਹੁੰਚਾਣਾ ਪਹੁੰਚ ਕਰ ਰਹੇ ਨੇ ਇਸ ਤੇ ਕਾਰਵਾਈ ਕੀਤੀ ਜਾ ਸਕਦੀ ਹੈ